ਪੰਜਾਬੀ ਭਾਸ਼ਾ ਨੂੰ ਗੁਰਮੁਖੀ ਭਾਸ਼ਾ ਕਹਿੰਦੇ ਹਨ ਪੰਜਾਬੀ ਭਾਰਤ ਦੇ ਪਾਕਿਸਤਾਨ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਪਰ ਹੁਣ ਪੰਜਾ ਪੰਜਾਬੀ ਹੋਰ ਵੀ ਕਈ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ ਜਿਵੇਂ ਕਿ ਪੰਜਾਬੀ ਕਹਿੰਦੇ ਹਨ ਉੱਥੇ ਹੀ ਪੰਜਾਬੀ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਸੱਭਿਆਚਾਰ ਦੇ ਪ ਪੱਖੇ ਵੀ ਕਾਫ਼ੀ ਚੰਗੇ ਹਨ ਇਹ ਗੁਰੂ ਦੀ ਦਿੱਤੀ ਭਾਸ਼ਾ ਹੈ ਪੰਜਾਬੀ ਬੋਲੀ 'ਤੇ ਹੀ ਸਾਡੇ ਸੱਭਿਆਚਾਰ ਬਾਰੇ ਜਾਣਿਆ ਜਾ ਸਕਦਾ ਹੈ ਪਰ ਅੱਜ ਕੱਲ੍ਹ ਲੋਕ ਪੰਜਾਬੀ ਨੂੰ ਪਿੱਛੇ ਕਰਕੇ ਦੂਜੀਆਂ ਭਾਸ਼ਾ ਵੱਲ ਵੱਧ ਰਹੇ ਹਨ ਸਾਨੂੰ ਪੰਜਾਬੀ 'ਤੇ ਮਾਣ ਹੈ ਅਤੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ